ਹਾਂ ਅਸੀਂ ਇਹ ਗੱਲ ਤਾਂ ਬਿਲਕੁਲ ਹੀ ਸੱਚ ਸੋਚਦੇ ਹਾਂ ਕਿ ਖੇਡਾਂ ਲੋਕਾਂ ਨੂੰ ਇਕੱਠਿਆ ਕਰਦੀਆਂ ਹਨ ਕਿਉਂਕਿ ਜੇਕਰ ਅਸੀਂ ਕੋਈ ਵੀ ਖੇਡ ਖੇਡਦੇ ਹਾਂ ਤਾਂ ਅਸੀਂ ਉਸ ਨੂੰ ਕੱਲੇ ਨਹੀਂ ਖੇਡ ਸਕਦੇ ਜਿਵੇਂ ਕਿ ਆਪਾਂ ਕਬੱਡੀ ਦੀ ਹੀ ਗੱਲ ਕਰਦੇ ਹਾਂ ਜੇਕਰ ਕਬੱਡੀ ਦੇ ਵਿੱਚ ਇੱਕ ਵਿਅਕਤੀ ਖੇਡਣ ਲੱਗੇ ਤਾਂ ਉਸ ਨੂੰ ਨਹੀਂ ਖੇਡ ਸਕਦਾ ਕਿਉਂਕਿ ਉਸ ਦੇ ਵਿੱਚ ਆਪਣੀ ਟੀਮ ਦੇ ਵਿੱਚ ਵੀ ਪੰਜ ਛੇ ਵਿਅਕਤੀ ਹੋਣੇ ਚਾਹੀਦੇ ਹਨ ਅਤੇ ਸਾਡੀ ਵਿਰੋਧੀ ਧਿਰ ਟੀਮ ਦੇ ਵਿੱਚ ਵੀ ਵਿਅਕਤੀ ਹੋਣੇ ਚਾਹੀਦੇ ਹਨ ਜਿਸ ਦੇ ਨਾਲ਼ ਗੇਮ ਦਾ ਇੱਕ ਮੁੱਠ ਹੋ ਕੇ ਜੁੱਟਤਾ ਵੱਧਦਾ ਹੈ ਇਸ ਦੇ ਨਾਲ਼ ਲੋਕਾਂ ਦੇ ਵਿੱਚ ਵੀ ਸਹਿਯੋਗ ਅਤੇ ਉਤਸ਼ਾਹ ਵੱਧਦਾ ਹੈ ਅਤੇ ਇਸ ਨੂੰ ਦੇਖ ਕੇ ਲੋਕ ਵੀ ਬਹੁਤ ਖੁਸ਼ ਹੁੰਦੇ ਹਨ ਅਤੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਪਿਆਰ ਮੁਹੱਬਤ ਵੱਧਦੀ ਹੈ ਇਸ ਦੇ ਨਾਲ਼ ਸਾਰੇ ਲੋਕ ਇੱਕ ਜਗ੍ਹਾ ਸਾਰੇ ਇੱਕ ਦੂਜੇ ਨੂੰ ਸਨਮਾਨ ਕਰਦੇ ਹਨ ਅਤੇ ਸਾਨੂੰ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ